ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਪਟਿਆਲਾ ਤੋਂ ਬੋਲ ਰਿਹਾ ਜੀ ਦੁੱਖਨਿਵਾਰਨ ਸਾਹਿਬ ਦੇ ਗੁਰ ਹਾਂਜੀ ਹਾਂ ਜੀ ਅਤੇ ਹਾਂ ਇਹ ਨੌਵੀਂ ਪਾਤਸ਼ਾਹੀ ਦੀ ਯਾਦ 'ਚ ਬਣਾਇਆ ਗਿਆ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ 'ਚ ਅਤੇ ਉਹਨਾਂ ਨੇ ਕਈਆਂ ਦੇ ਰੋਗ ਤੋੜੇ ਸੀ ਇੱਥੇ ਇੱਕ ਤਲਾਬ ਹੁੰਦਾ ਸੀ ਅਤੇ ਉਹਦੇ ਵਿੱਚ ਜਿਹੜਾ ਵੀ ਨਹਾਉਂਦਾ ਸੀ ਉਹਦੀ ਬਿਮਾਰੀ ਦੂਰ ਹੋ ਜਾਂਦੀ ਸੀ ਜੀ ਕਈ ਕਈਆਂ ਦੇ ਇੱਥੇ ਬਿਮਾਰੀਆਂ ਦੂਰ ਹੋਈਆਂ ਇੱਕ ਬੱਚਾ ਅਪਹਾਇਜ ਸੀ ਉਹ ਤੁਰਨ ਫਿਰਨ ਲੱਗ ਗਿਆ ਸੀ ਜੀ ਅਤੇ ਅ ਅੱਜ ਵੀ ਲੋਕ ਬਹੁਤ ਸ਼ਰਧਾ ਭਾਵਨਾ 'ਤੇ ਇੱਥੇ ਆਉਂਦੇ ਨੇ ਬਸੰਤ ਪੰਚਮੀ ਦੇ ਇੱਥੇ ਬਹੁਤ ਇਕੱਠ ਹੁੰਦਾ ਜੀ ਭਾਰੀ ਜੋੜ ਮੇਲਾ ਲੱਗਦਾ ਜੀ ਚੰਗਾ ਪੂਰਾ ਭਰ ਕੇ ਲੱਗਦਾ ਜੀ ਇੱਥੇ ਇੱਕ ਪ੍ਰਿਤਪਾਲ ਸਿੰਘ ਜੀ ਕਥਾ ਕਰਦੇ ਨੇ ਹਜ਼ੂਰੀ ਕਥਾ ਵਾਚਕ ਨੇ ਜੀ ਪੱਕੇ ਹਾਂਜੀ ਜਿੰਨੇ ਵੀ ਵੱਡੇ ਕਥਾ ਵਾਚਕ ਨੇ ਸਾਰੇ ਇੱਥੇ ਹੀ ਆਉਂਦੇ ਹੁੰਦੇ ਨੇ ਗਿਆਨੀ ਸ਼ੇਰ ਸਿੰਘ ਜੀ ਅਸੀਂ ਪੱਕੇ ਰੱਖੇ ਹੋਏ ਨੇ ਹਾਂਜੀ ਹਾਂਜੀ ਹਾਂਜੀ ਅਸੀਂ ਵੀ ਥੋੜ੍ਹੇ ਪ੍ਰੋਗਰਾਮ ਲਾ ਲੈਂਦੇ ਹਾਂ ਅਤੇ ਨਾਲ ਬੱਚਿਆਂ ਨੂੰ ਵੀ ਜਾਗਰੂਕ ਕਰੀਦਾ ਜੀ ਕਿ ਆਪਣੇ ਸਿੱਖੀ ਨਾਲ ਜੁੜੇ ਰਹਿਣ ਜੀ ਇਹਦਾ ਨਾਮ ਹਾਂਜੀ ਹਾਂਜੀ ਜ਼ਰੂਰ ਆਓ ਜੀ ਦਰਸ਼ਨ ਕਰੋ ਰੂਬਰੂ ਹੋ ਮਹਾਰਾਜ ਦੇ ਅਤੇ ਇਹਦਾ ਨਾਮ ਹੀ ਦੁੱਖਨਿਵਾਰਨ ਸਾਹਿਬ ਇਸ ਕਰਕੇ ਰੱਖਿਆ ਇਹ ਸਭ ਦੇ ਦੁੱਖ ਨਿਵਾਰਦਾ ਜੀ ਅਤੇ ਸਭ ਦੇ ਦੁੱਖ ਹਰ ਦੁੱਖ ਹਰ ਲੈਂਦਾ ਜੀ ਚਲੋ ਠੀਕ ਹੈ ਜੀ ਕੋਈ ਨਹੀਂ ਪੰਚਮੀ ਆ ਲੈਣ ਦਿਓ ਫਿਰ ਮਿਲਦੇ ਹਾਂ ਜੀ ਉੱਥੇ ਉੱਥੇ ਬਹਿ ਕੇ ਤੁਹਾਨੂੰ ਸਾਰਾ ਇਤਿਹਾਸ ਦੱਸਾਂਗੇ ਜਿਹੜਾ ਹੈ ਮੁੱਢਲਾ ਇਤਿਹਾਸ ਸਾਰਾ ਸਮਝਾਵਾਂਗੇ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ